ਅੱਜ ਕੱਲ੍ਹ ਓਨਲਾਈਨ ਕਮਾਉਣ ਦਾ ਕਾਫ਼ੀ ਹੀ ਜ਼ਿਆਦਾ ਦੌਰ ਚੱਲ ਰਿਹਾ ਹੈਗਾ ਆ ਮੈਂ ਇੱਕ ਦੋ ਵਾਰ ਕੋਸ਼ਿਸ਼ ਕੀਤੀ ਸੀਗੀ ਮੈਂ ਓਨਲਾਈਨ ਸਮਾਨ ਮੰਗਵਾਇਆ ਤਾਂ ਉਹਦੇ ਵਿੱਚ ਮੇਰੇ ਕੋਲ ਪੈਸੇ ਗਲਤ ਚਲੇ ਗਏ ਤਾਂ ਨਾ ਮੇਰੇ ਪੈਸੇ ਆਏ ਅਤੇ ਨਾ ਸਮਾਨ ਆਇਆ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਘਬਰਾ ਗਈ ਕਿ ਮੈਂ ਕੋ ਓਨਲਾਈਨ ਕੰਮ ਨਹੀਂ ਹੁੰਦਾ ਤੇ ਵੈਸੇ ਤਾਂ ਮੇਰੀ ਮੇਰੀਆਂ ਸਹੇਲੀਆਂ ਕਰਦੀਆਂ ਹੈਗੀਆਂ ਆ ਉਹਨਾਂ ਨੇ ਹੀ ਮੈਨੂੰ ਕਿਹਾ ਸੀ ਤੁਸੀਂ ਵੀ ਓਮਲਾਈਨ ਕੰਮ ਸ਼ੁਰੂ ਕਰੋ ਅਤੇ ਮੈਂ ਫਿਰ ਉਸ ਤੋਂ ਬਾਅਦ ਮੈਨੂੰ ਥੋੜ੍ਹਾ ਜਿਹਾ ਡਰ ਲੱਗਦਾ ਰਿਹਾ ਫਿਰ ਮੈਂ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਅਤੇ ਉਹ ਮੈਨੂੰ ਫਿਰ ਵੀ ਕਹਿੰਦੀਆਂ ਕਰਦੀਆਂ ਹਜੇ ਤੱਕ ਉਹ ਕਰਦੀਆਂ ਮੈਨੂੰ ਕਹਿੰਦੀਆਂ ਰਹਿੰਦੀਆਂ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਕਰੋ ਤ ਪਰ ਮੈਨੂੰ ਥੋੜਾ ਜਿਹਾ ਡਰ ਲੱਗਦਾ ਹੈਗਾ ਆ ਇਸ ਕਰਕੇ ਮੈਂ ਹਜੇ ਨਹੀਂ ਕਰ ਰਹੀ